ਸਤਿ ਸ਼੍ਰੀ ਅਕਾਲ ਮੈਨੂੰ ਰੋਟੀ ਬਣਾਉਣਾ ਬਚਪਨ ਤੋਂ ਹੀ ਬਹੁਤ ਵਧੀਆ ਲੱਗਦਾ ਆ ਜਦੋਂ ਵੀ ਮੈਂ ਕਦੀ ਕਿਸੇ ਦੀ ਬਣਾਈ ਚੀਜ਼ ਖਾਂਦੀ ਹਾਂ ਤਾਂ ਮੈਨੂੰ ਉਹ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਉਸ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੈਂ ਉਸ ਤੋਂ ਪਹਿਲਾਂ ਹੀ ਉਸ ਦੀ ਰੈਸਪੀ ਬਾਰੇ ਪੁੱਛਦੀ ਹਾਂ ਮੈਂ ਉਸਦੀ ਰੈਸਪੀ ਦੇ ਕੁਛ ਕੁਛ ਹੀ ਚੀਜ਼ਾਂ ਅਪਣਾਉਂਦੀ ਹਾਂ ਅਤੇ ਕੁਛ ਕੁਛ ਮੈਂ ਆਪਣਾ ਤਰੀਕਾ ਅਪਣਾਉਂਦੀ ਹਾਂ ਤਾਂ ਕਿ ਮੈਂ ਉਸ ਤੋਂ ਵੀ ਵਧੀਆ ਬਣਾ ਸਕਾਂ ਫਿਰ ਜਦੋਂ ਮੈਂ ਉਸਨੂੰ ਉਸਨੂੰ ਉਹ ਬਣਾਉਂਦੀ ਹਾਂ ਫਿਰ ਮੈਂ ਉਹ ਸਾਰਿਆਂ ਨੂੰ ਫਿਰ ਮੈਂ ਉਸ ਜਿਸ ਬੰਦੇ ਦੀ ਮੈਂ ਚੀਜ਼ ਖਾਧੀ ਹੁੰਦੀ ਹੈ ਉਸਨੂੰ ਟੇਸਟ ਕਰਵਾਉਂਦੀ ਆ ਅਤੇ ਓ